ਮੇਰੇ ਚੱਲਣ ਵਾਲੇ ਜੁੱਤੇ ਸਪੋਰਟਸ ਸ਼ੂਜ਼ ਹਨ ਅਤੇ ਮੈਂ ਉਹਨਾਂ ਨੂੰ ਤਰਜੀਹ ਇਸ ਲਈ ਦਿੰਦਾ ਹਾਂ ਕਿਉਂਕਿ ਉਹ ਬਹੁਤ ਕੰਫਰਟੇਬਲ ਹਨ ਉਹਨਾਂ ਵਿੱਚ ਤੁਰਨਾ ਬਹੁਤ ਆਰਾਮਦਾਇਕ ਹੈ ਉਹਨਾਂ ਦੇ ਅੰਦਰ ਰੂੰ ਲੱਗੀ ਹੋਈ ਹੈ ਅਤੇ ਮੇਰੇ ਪੈਰ ਵੀ ਉਹਦੇ 'ਚ ਨਹੀਂ ਦੁਖਦੇ ਅਤੇ ਮੇਰੇ ਕੋਲ ਮੈਂ ਹਰ ਕੱਪੜੇ 'ਚ ਆਰਾਮਦਾਇਕ ਨਹੀਂ ਹਾਂ ਮੇਰੇ ਕੋਲ ਇੱਕ ਕਿੱਟ ਹੈ ਜੋ ਮੈਂ ਜਦੋਂ ਸਪੋਰਟਸ ਖੇਡਣ ਜਾਂਦਾ ਹਾਂ ਅਤੇ ਮੈਂ ਉਹਨੂੰ ਪਹਿਨਦਾ ਹਾਂ ਅਤੇ ਮੈਂ ਬਹੁਤ ਆਰਾਮਦਾਇਕ ਮਹਿਸੂਸ ਕਰਦਾ ਹਾਂ